ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਡੋਕਟਰ ਸਾਹਿਬ ਹਾਂਜੀ ਡਾਕਟਰ ਸਾਹਿਬ ਇੱਕ ਮੇਰਾ ਬ੍ਰਦਰ ਸੀਗਾ ਪੇਸ਼ੈਂਟ ਤੁਹਾਡੇ ਕੋਲ ਉਹ ਨਸ਼ੇ ਨਸ਼ੇ ਨੁਸ਼ੇ ਬੜੇ ਕਰਦਾ ਮਤਲਬ ਕਿ ਮੇਰੇ ਚਾਚਾ ਜੀ ਦਾ ਲੜਕਾ ਉਹ ਨਸ਼ੇ ਬੜੇ ਨਸ਼ੇ ਬੜੇ ਕਰਦਾ ਉਹ ਅਤੇ ਡਰਿੰਕ ਵਗੈਰਾ ਬੜੀ ਕਰਦਾ ਤਾਂ ਉਹਨੂੰ ਕਿੱਦਾਂ ਉਹਦਾ ਕਰਵਾਈਏ ਅੱਛਾ ਜੀ ਅਤੇ ਕੀ ਪ੍ਰੋਸੈਸਰ ਕੀ ਹੈ ਦਵਾਈ ਦਾ ਜੀ ਕੀ ਪ੍ਰੋਸੈਸ ਹੈ ਅੱਛਾ ਜੀ ਬਿਨਾਂ ਦੱਸੇ ਦੇਣੀ ਆ ਜੀ ਅਤੇ ਖਾਣ ਖਾਣ ਖੁਣ ਦਾ ਪਰਹੇਜ ਜੀ ਕੋਈ ਠੀਕ ਆ ਜੀ ਅਤੇ ਉਹਦਾ ਕਿੰਨਾ ਖਰਚਾ ਮੈਡੀਸਨ ਦਾ ਜੀ ਠੀਕ ਆ ਜੀ ਅਤੇ ਕਦੋਂ ਆ ਸਕਦਾ ਜੀ ਮੈਂ

ਠੀਕ ਆ ਜੀ ਕੋਈ ਛੁੱਟੀ ਵਗੈਰਾ ਕੋਈ ਵਿੱਚ ਹੋਲੀਡੇਅ ਵਗੈਰਾ ਕੋਈ ਹੁੰਦਾ ਛੁੱਟੀ ਵਗੈਰਾ ਕੋਈ ਠੀਕ ਹੈ ਚਲੋ ਮੈਂ ਨੈਕਸਟ ਮੰਡੇ ਨੂੰ ਆ ਜਾਂਦਾ ਫਿਰ ਤੁਹਾਡੇ ਕੋਲ ਠੀਕ ਆ ਜੀ ਮਿਹਰਬਾਨੀ ਕੁਛ ਹੋਰ ਦੱਸਣਾ ਜੀ ਕੋਈ ਦੱਸ ਦਿਓ ਕੋਈ ਹੋਰ ਗੱਲ ਚਲੋ ਠੀਕ ਠੀਕ ਆ ਜੀ ਠੀਕ ਆ ਮਿਹਰਬਾਨੀ